ਉਣਾਨਵੇਂ ਪੰਜ ਸੌ ਸੱਤਰ ਦੋ ਹਜ਼ਾਰ ਛੇ ਸੌ ਅਠਾਨਵੇਂ ਦਸ ਹਜ਼ਾਰ ਤਿੰਨ ਸੌ ਸਤੱਤਰ ਇੱਕ ਲੱਖ ਪੰਦਰਾਂ ਹਜ਼ਾਰ ਦੋ ਸੌ ਪੱਚੀ